ਤਕਨੋਲਜੀ ਨੇ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਕਿਉਂਕਿ ਜਦੋਂ ਦੇ ਸਮਾਰਟ ਫ਼ੋਨ ਆਏ ਨੇ ਜਾਂ ਇੰਟਰਨੈਟ ਦੀ ਸੁਵਿਧਾ ਮਿਲੀ ਹੈ ਤਾਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਇੱਕ ਦੂਜੇ ਨਾਲ ਜਿੱਥੇ ਗੱਲ ਕਰਦੇ ਸੀ ਉੱਥੇ ਵੀਡੀਓ ਕੋਲ ਦੇ ਰਾਹੀਂ ਇੱਕ ਦੂਜੇ ਸਥਾਨ ਨੂੰ ਅਸੀਂ ਵੇਖ ਵੀ ਸਕਦੇ ਹਾਂ ਅਤੇ ਉਹਨਾਂ ਚੀਜ਼ਾਂ ਦਾ ਅਸੀਂ ਅਨੁਭਵ ਵੀ ਕਰ ਸਕਦੇ ਹਾਂ ਟਿਕਟਾਂ ਅਤੇ ਹੋਟਲ ਬੈਂਕਿੰਗ ਆਦਿ ਦੀ ਜਿਹੜੀ ਭੁਗਤਾਨ ਸੀ ਜਾਂ ਕਿਰਿਆਵਾਂ ਸੀ ਸਾਰੀਆਂ ਉਹ ਇਸ ਟੈਕਨੋਲਜੀ ਨੇ ਬਹੁਤ ਹੀ ਵਧੀਆ ਲੈਵਲ 'ਤੇ ਜਾ ਕੇ ਸਾਨੂੰ ਸੁਵਿਧਾ ਦਿੱਤੀ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਖਰੀਦਦਾਰੀ ਕਰਨ ਲਈ ਜਿੱਥੇ ਸਾਨੂੰ ਬਹੁਤ ਦੂਰ ਤੱਕ ਜਾਣਾ ਪੈਂਦਾ ਸੀ ਜਾਂ ਕਿਸੇ ਸਾਧਨ ਦੀ ਲੋੜ ਹੁੰਦੀ ਸੀ ਉੱਥੇ ਖਰੀਦਦਾਰੀ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਔਨਲਾਈਨ ਹੋਣ ਕਰਕੇ ਇੱਕ ਨਿਵੇਕਲਾ ਸਥਾਨ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਦਾਨ ਕੀਤਾ ਹੈ